ਪਹਿਲੇ ਸਾਇੰਟਿਸਟ ਹੈਗੇ ਸੀ ਵੀ ਰਮਨ ਜੀ ਇਹਨਾਂ ਦਾ ਜਨਮ ਹੋਇਆ ਸੱਤ ਨਵੰਬਰ ਅਠਾਰਾਂ ਸੌ ਅਠਾਸੀ ਇਹਨਾਂ ਨੇ ਲਾਈਟਸ ਕੈਟਰਿੰਗ ਦੇ ਉੱਪਰ ਕੰਮ ਕੀਤਾ ਜਿਹਨਾਂ ਕਰਕੇ ਕਿ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਫਿਜਿਕਸ ਦੇ ਵਿੱਚ ਅਤੇ ਇਹਨਾਂ ਨੇ ਲਾਈਟਸ ਕੈਟਰਿੰਗ ਦਾ ਕੰਮ ਕੀਤਾ ਅਤੇ ਜਿਹਦੇ ਕਰਕੇ ਕਿ ਰਮਨ ਸਪੈਕਟਰੋਸਕੋਪੀ ਨਾਮ ਦੇ ਨਾਲ ਇਹ ਮਸ਼ਹੂਰ ਹਨ ਦੂਜੇ ਸਾਇੰਟਿਸਟ ਹੈਗੇ ਹੈਗੇ ਹੋਮੀ ਜੇ ਬਾਬਾ ਜੀ ਇਹਨਾਂ ਦਾ ਜਨਮ ਹੋਇਆ ਤੀਹ ਅਕਤੂਬਰ ਉੱਨੀ ਸੌ ਨੌਂ ਨੂੰ ਜਿਹਨਾਂ ਨੇ ਕਿ ਨਿਊਕਲੀਅਰ ਫਿਜਿਕਸ ਦੇ ਅੰਦਰ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੰਡੀਅਨ ਨਿਊਕਲੀਅਰ ਪ੍ਰੋਗਰਾਮ ਦੇ ਇਹ ਫਸਟ ਚੇਅਰਮੈਨ ਸੀਗੇ ਇਹਨਾਂ ਨੇ ਐਟੋਮਿਕ ਐਨਰਜੀ ਕਮਿਸ਼ਨ ਦੇ ਉੱਪਰ ਵੀ ਕੰਮ ਕੀਤਾ ਜੋ ਕਿ ਇਹ ਉੱਥੇ ਹੀ ਆਪਣੇ ਚੇਅਰਮੈਨਸ਼ਿਪ ਦੇ ਨਾਲ ਹੀ ਜਾਣੇ ਜਾਂਦੇ ਸੀਗੇ ਤੀਜੇ ਸਾਇੰਟਿਸਟ ਹੈਗੇ ਅਬਦੁਲ ਜੇ ਕਲਾਮ ਜੀ ਇਹਨਾਂ ਨੂੰ ਮਿਸਾਈਲ ਮੈਨ ਵੀ ਕਿਹਾ ਜਾਂਦਾ ਹੈ ਭਾਰਤ ਦਾ ਅਤੇ ਇਹ ਭਾਰਤ ਦੇ ਗਿਆਰਵੇਂ ਪ੍ਰੈਸੀਡੈਂਟ ਸੀਗੇ ਟੈਕਨੀਕਲੀ ਪੋਲੀਟੀਕਲੀ ਇਹਨਾਂ ਦਾ ਰੋਲ ਸੀਗਾ ਪੋਖਰਨ ਦੋ ਦੇ ਵਿੱਚ